ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਸਪੋਰਟਸ ਅਕੈਡਮੀ ਤੋਂ ਬੋਲ ਰਹੇ ਹੋ ਤੁਸੀਂ ਓਕੇ ਸਾਨੂੰ ਕਿਸੇ ਨੇ ਰੈਫਰੈਂਸ ਦਿੱਤੀ ਸੀ ਅਸੀਂ ਨੰਬਰ ਲਿਆ ਉਸ ਬਾਰੇ ਪੁੱਛਣਾ ਸੀ ਅਸੀਂ ਅਸੀਂ ਫੁੱਟਬਾਲ ਦੇ ਮਤਲਬ ਬਾਰੇ ਮੈਂ ਆਪਣੀ ਸਪੋਰਟਸ ਪਰਸਨ ਹਾਂ ਫੁੱਟਬਾਲ ਦੇ ਬਾਰੇ ਟਰੇਨਿੰਗ ਲੈਣੀ ਸੀ ਆਪਣੇ ਪਰਫੋਰਮੈਂਸ ਬੈਸਟ ਕਰਨ ਵਾਸਤੇ ਹਾਂਜੀ ਮੈਂ ਹੀ ਲੈਣੀ ਸੀਗੀ ਪਰਸਨਲੀ ਓਕੇ ਠੀਕ ਹੈ ਓਕੇ ਕੀ ਟਾਈਮਿੰਗ ਵਗੈਰਾ ਤੁਹਾਡੇ ਮੈਮ ਸ਼ੈਸ਼ਨ ਓਕੇ ਟੂ ਮੰਥ ਟਾਈਮਿੰਗ ਕੀ ਹੈ ਮੋਰਨਿੰਗ ਈਵਨਿੰਗ ਸ਼ੈਸ਼ਨ ਦੀ ਠੀਕ ਹੈ ਚਾਰ ਤੋਂ ਅੱਠ ਤੱਕ ਨਾ ਸ਼ਾਮ ਨੂੰ ਓਕੇ ਫੁੱਟਬਾਲ ਔਰ ਉਹ 'ਚ ਡਰੈਸ ਵਗੈਰਾ ਫਿਰ ਤੁਸੀਂ ਅਵੇਲ ਪ੍ਰੋਵਾਈਡ ਕਰਦੇ ਹੋ ਕਿ ਸਾਨੂੰ ਆਪਣੀ ਲੈਣੀ ਪਵੇਗੀ ਓਕੇ ਅਤੇ ਤੁਹਾਡੇ ਮਤਲਬ ਰੇਟ 'ਚ ਥੋੜ੍ਹਾ ਬਹੁਤਾ ਲੈਸ ਹੋ ਸਕਦਾ ਫਿਲਹਾਲ ਦੋ ਮੰਥ ਵਾਲਾ ਠੀਕ ਰਹੇਗਾ ਟੂ ਮੰਥ 'ਚ ਕਿੰਨੀ ਪਰਫੋਰਮੈਂਸ ਹੋ ਜਾਵੇਗੀ ਅ ਸਾਡੀ ਕਿੰਨਾ ਕੁ ਸੁਧਾਰ ਆਵੇਗਾ ਉਹ 'ਚ

ਓਕੇ ਠੀਕ ਹੈ ਕਲਾਸਿਸ ਰਿਟਨ ਨਾਲ ਕਲਾਸਿਸ ਵੀ ਦਿੰਦੇ ਹੋ ਤੁਸੀਂ ਫੁੱਟਬਾਲ ਦੇ ਬਾਰੇ ਥਿਊਰੀ ਓਕੇ ਔਰ ਪ੍ਰੈਕਟੀਕਲ ਵੀ ਮੈਚਸ ਵਗੈਰਾ ਮੈਚ ਵਗੈਰਾ ਕਰਵਾਉਂਦੇ ਹੋ ਡਿਸਟ੍ਰਿਕ 'ਤੇ ਜਾਂ ਬਾਹਰ ਕਿਤੇ ਮੈਚ ਵਗੈਰਾ ਓਕੇ ਠੀਕ ਹੈ ਟਰੇਨਿੰਗ ਤੋਂ ਬਾਅਦ ਸਾਨੂੰ

ਹਾਂਜੀ ਠੀਕ ਹੈ ਟਰੇਨਿੰਗ ਤੋਂ ਬਾਅਦ ਫਿਰ ਕੀ ਪ੍ਰੋਸੈਸ ਰਹੇਗਾ ਨਹੀਂ ਟ੍ਰੇਨਿੰਗ ਬਾਅਦ ਸਾਨੂੰ ਸਰਟੀਫਿਕੇਟ ਵਗੈਰਾ ਕੀ ਮਿਲੇਗਾ ਟਰੇਨਿੰਗ ਦਾ ਪਰੂਫ ਕਿ ਅਸੀਂ ਕੀਤੀ ਹੈ ਠੀਕ ਹੈ ਜੀ ਉਹ ਸਾਨੂੰ ਟ੍ਰੇਨਿੰਗ ਤੋਂ ਬਾਅਦ ਮਿਲ ਜਾਏਗਾ ਨਾਲ ਦੀ ਨਾਲ ਠੀਕ ਹੈ ਜੇ ਟ੍ਰੇਨਿੰਗ ਤੋਂ ਬਾਅਦ ਸਾਨੂੰ ਲੱਗਦਾ ਕਿ ਨਹੀਂ ਫਿਰ ਤੁਹਾਡੀ ਇਹ ਸ਼ੋਰਟੀ ਹੈ ਕਿ ਸਾਨੂੰ ਸਾਡੀ ਪਰਫੋਰਮੈਂਸ 'ਚ ਸੁਧਾਰ ਆਵੇਗਾ ਦੋ ਮਹੀਨਿਆਂ 'ਚ ਠੀਕ ਹੈ ਮੈਮ ਓਕੇ ਓਕੇ ਥੈਂਕ ਯੂ